ਪਿਛਲੇ ਸਾਲ ਮੈਂ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਜੂਨ ਮਹੀਨੇ ਦੇ ਵਿੱਚ ਗਿਆ ਸੀ ਅਤੇ ਜਦੋਂ ਉੱਥੇ ਪਹੁੰਚੇ ਤਾਂ ਹੇਮਕੋਟ ਸੋ ਹੇਮਕੁੰਟ ਸਾਹਿਬ ਤੋਂ ਪਹਿਲਾਂ ਇੱਕ ਗੁਰਦੁਆਰਾ ਆਉਂਦਾ ਹੈ ਉੱਥੇ ਅਸੀਂ ਰੁਕੇ ਤਾਂ ਉੱਥੇ ਇੱਕ ਮੈਨੂੰ ਬੜਾ ਝਟਕਾ ਮਹਿਸੂਸ ਹੋਇਆ ਇਹ ਚੀਜ਼ ਦੇਖ ਕੇ ਕਿ ਉੱਥੇ ਕੁਝ ਦਿੱਲੀ ਵਾਲੇ ਪਾਸੇ ਤੋਂ ਜਾਂ ਮੇਰੇ ਖਿਆਲ ਦਿੱਲੀ ਅਤੇ ਯੂ ਪੀ ਵਾਲੇ ਪਾਸੇ ਤੋਂ ਯਾਤਰੀ ਆਏ ਹੋਏ ਸਨ ਉਹ ਗੁਰਦੁਆਰਾ ਸਾਹਿਬ ਦੇ ਜੋ ਅੰਦਰ ਰਿਹਾਇਸ਼ ਸੀ ਉਹਦੇ ਵਿੱਚ ਹੀ ਅ ਆਪਣੀ ਜੇਬਾਂ 'ਚ ਜਰਦਾ ਗੁਟਕਾ ਲੈ ਕੇ ਪਹੁੰਚੇ ਹੋਏ ਸਨ ਅਤੇ ਜਦੋਂ ਮੈਂ ਕਿਉਂਕਿ ਮੇਰਾ ਵੀ ਉੱਥੇ ਨਾਲ ਹੀ ਉਹਨਾਂ ਦਾ ਕਮਰਾ ਸੀ ਤਾਂ ਜਦੋਂ ਮੈਂ ਉੱਥੇ ਉਹਨਾਂ ਨੂੰ ਦੇਖਿਆ ਤਾਂ ਉਹ ਕਮਰੇ 'ਚ ਬੈਠੇ ਜਰਦਾ ਮਲਦੇ ਸਨ ਤਾਂ ਮੈਨੂੰ ਉਹ ਇੱਕ ਤਰ੍ਹਾਂ ਦਾ ਬੜਾ ਝਟਕਾ ਮਹਿਸੂਸ ਹੋਇਆ ਕਿਉਂਕਿ ਸਾਡੇ ਜੋ ਸਿੱਖ ਧਰਮ ਦੇ ਵਿੱਚ ਅ ਖਾਸ ਕਰ ਗੁਰਦੁਆਰਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਅ ਕੋਈ ਵੀ ਨਸ਼ਾ ਅੰਦਰ ਲੈ ਕੇ ਜਾ ਕਰਕੇ ਜਾਣਾ ਸਖ਼ਤ ਮਨ੍ਹਾ ਹੈ ਜਿਹੜਾ ਕਿ ਮੈਨੂੰ ਇੱਕ ਅ ਬਹੁਤ ਹੀ ਸੱਭਿਆਚਾਰਕ ਝਟਕੇ ਕਿਉਂਕਿ ਇਹ ਸਾਡਾ ਸੱਭਿਆਚਾਰ ਹੈ ਕਿ ਅਸੀਂ ਆਪਣੇ ਸੱਭਿਆਚਾਰ ਦੇ ਵਿੱਚ ਸਾਡੇ ਇਹ ਗੱਲ ਕਹੀ ਗਈ ਹੈ ਕਿ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਹੈ ਪਰ ਉੱਥੇ ਗੁਰਦੁਆਰੇ ਦੇ ਵਿੱਚ ਹੀ ਉੱਥੇ ਜੋ ਰਿਹਾਇਸ਼ ਹੈ ਉੱਥੇ ਉਹ ਇਸ ਤਰੀਕੇ ਤੰਬਾਕੂ ਜਰਦਾ ਅਤੇ ਗੁਟਕਾ ਲੈ ਕੇ ਪਹੁੰਚੇ ਹੋਏ ਸਨ ਜੋ ਕਿ ਇੱਕ ਬਹੁਤ ਹੀ ਗਲਤ ਮੈਨੂੰ ਬਹੁਤ ਜ਼ਿਆਦਾ ਗਲਤ ਲੱਗਿਆ